ਜੀ ਹਾਂ ਪਿਛਲੀ ਹਫ਼ਤੇ ਮੇਰੀ ਇੱਕ ਬਹੁਤ ਕਰੀਬੀ ਦੋਸਤ ਦਾ ਜਨਮ ਦਿਨ ਆਇਆ ਸੀ ਮੈਂ ਉਹਦੇ ਲਈ ਬਹੁਤ ਕੁਛ ਕਰਨਾ ਚਾਹੁੰਦਾ ਸੀ ਕਿਉਂਕਿ ਉਹ ਮੇਰੇ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਸਥਾਨ ਰੱਖਦੀ ਹੈ ਮੈਂ ਗੱਲ ਕਰਾਂ ਤਾਂ ਉਹਦੇ ਜਨਮ ਦਿਨ 'ਤੇ ਮੈਂ ਇੱਕ ਪਾਰਟੀ ਔਰਗਨਾਈਜ਼ ਕੀਤੀ ਜੋ ਕਿ ਸ਼ਾਮ ਨੂੰ ਰੱਖੀ ਗਈ ਸੀ ਮੈਂ ਉਹਦੇ ਲਈ ਬਹੁਤ ਸਾਰੇ ਤੋਹਫ਼ੇ ਲਏ ਅਤੇ ਉਹਦੀ ਮਨ ਪਸੰਦ ਚੋਕਲੇਟ ਵੀ ਲਈ ਸ਼ਾਮੀਂ ਜਦੋਂ ਆਪਾਂ ਦੋਹੇ ਖਾਣ ਲਈ ਬਾਹਰ ਗਏ ਤਾਂ ਮੈਂ ਉਸ ਸਮੇਂ ਥੋੜ੍ਹੀ ਦੇਰ ਬਾਅਦ ਉਹਨੂੰ ਉਹਦੇ ਤੋਹਫ਼ੇ ਫੜਾਏ ਅਤੇ ਨਾਲੇ ਸ਼ਾਇਰੀ ਲਿਖੀ ਹੋਈ ਕਾਰਡ ਦੇ ਵਿੱਚ ਵੀ ਦਿੱਤੀ ਉਹਨੇ ਸ਼ਾਇਰੀ ਪੜ੍ਹੀ ਅਤੇ ਉਹ ਬਹੁਤ ਭਾਵੁਕ ਹੋ ਗਈ ਨਾਲ ਦੇ ਨਾਲ ਹੀ ਉਹਨੇ ਮੈਨੂੰ ਗਲ਼ ਨਾਲ ਲਾ ਕੇ ਕਿਹਾ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰਾ ਜਨਮ ਦਿਨ ਇੰਨਾ ਸ਼ਪੈਸ਼ਲ ਬਣਾਉਣ ਦੇ ਲਈ ਉਹਨੂੰ ਮੇਰੇ ਦਿੱਤੇ ਹੋਏ ਸਾਰੇ ਤੋਹਫ਼ੇ ਵੀ ਬਹੁਤ ਪਸੰਦ ਆਏ ਕਿਉਂਕਿ ਉਹ ਸਾਰੇ ਦੇ ਸਾਰੇ ਤੋਹਫ਼ੇ ਉਹੀ ਸਨ ਜੋ ਕਿ ਉਹ ਲੈਣਾ ਚਾਹੁੰਦੀ ਸੀ ਉਹ ਸ਼ਾਇਰੀ ਪੜ੍ਹ ਕੇ ਵੀ ਬਹੁਤ ਖੁਸ਼ ਹੋਈ ਜੋ ਕਿ ਬਹੁਤ ਹੀ ਵਧੀਆ ਲੱਗਿਆ ਮੈਨੂੰ